ਹੈਲੋ ਹਾਂਜੀ ਭਾਈ ਸਾਹਿਬ ਕਿਉਂ ਭਾਈ ਸਾਹਿਬ ਨਹੀਂ ਨਹੀਂ ਭਾਈ ਸਾਹਿਬ ਵੇਖੋ ਤੁਹਾਡਾ ਦੁੱਧ ਅਸੀਂ ਜਿਹੜਾ ਦੁੱਧ ਤੁਹਾਨੂੰ ਦਿੰਦੇ ਹਾਂ ਅਸੀਂ ਉਹ ਹੋਰ ਸਾਰੇ ਘਰਾਂ 'ਚ ਹੀ ਜਾ ਰਿਹਾ ਹੈ ਪਰ ਕਿਸੇ ਘਰੋਂ ਕੋਈ ਸ਼ਿਕਾਇਤ ਨਹੀਂ ਮਿਲੀ ਹਜੇ ਤੱਕ ਮੈਨੂੰ ਕੋਈ ਵੀ ਉਲਾਂਭਾ ਨਹੀਂ ਆਇਆ ਆਪਾਂ ਨੂੰ ਅਤੇ ਤੁਸੀਂ ਦੱਸੋ ਦਿੱਕਤ ਕੀ ਆ ਰਹੀ ਹੈ ਭਾਈ ਸਾਹਿਬ ਕਦੋਂ ਤੋਂ ਹੋ ਰਿਹਾ ਹੈ ਮਤਲਬ ਤੁਹਾਨੂੰ ਇੱਕ ਹਫ਼ਤੇ ਤੋਂ ਲੱਗਿਆ ਪਹਿਲਾਂ ਸਈ ਆਉਂਦਾ ਪਿਆ ਸੀ ਨਹੀਂ ਨਹੀਂ ਪਤਾ ਹੈ ਵੈਸੇ ਭਾਈ ਸਾਹਿਬ ਜਿਹੜਾ ਤਾਂ ਦੇਖੋ ਆਪਾਂ ਤਾਂ ਪਿਓਰ ਦਾ ਦੁੱਧ ਵੇਚਦੇ ਹਾਂ ਆਪਾਂ ਕੋਈ ਤੁਹਾਨੂੰ ਐਨਾ ਮਹਿੰਗਾ ਮੱਝ ਵਾਲਾ ਲਿਆ ਕੇ ਤੁਹਾਨੂੰ ਕਿੱਥੋਂ ਦੇਵਾਂਗੇ ਐਨਾ ਸਸਤਾ ਅਤੇ ਇਹ ਤਾਂ ਹੋ ਹੀ ਨਹੀਂ ਸਕਦਾ

ਨਹੀਂ ਨਹੀਂ ਨਹੀਂ ਨਹੀਂ ਆਪਾਂ ਕੰਮ ਤਾਂ ਕਰਦੇ ਹੀ ਨਹੀਂ ਅਤੇ ਤੁਸੀਂ ਹੋ ਸਕਦਾ ਹੈ ਕਈ ਵਾਰੀ ਜਿਹੜੀ ਆਪਣਾ ਪਸ਼ੂ ਚਾਰਾ ਲੈਂਦਾ ਨਾ ਉਹ ਦੇ ਚਾਰੇ ਦੇ ਅਕੋਡਿੰਗ ਚਾਰੇ ਦੇ ਨਾਲ ਹੋ ਜਾਂਦਾ ਹੈ ਅਤੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਹੈ ਆਪਾਂ ਕੱਲ੍ਹ ਫੇਰ ਤੁਹਾਨੂੰ ਦੁੱਧ ਪਹੁੰਚਾਵਾਂਗੇ ਦੁਆਰਾ ਅਤੇ ਦੁੱਧ ਛੱਡਣਾ ਨਹੀਂ ਹੈ ਐਵੇਂ ਨਾ ਤੁਸੀਂ ਕਰੋ ਅਤੇ ਤੁਸੀਂ ਬਹੁਤ ਪੁਰਾਣੇ ਕਸਟ ਗਾਹਕ ਹੈਗੇ ਸਾਡੇ ਨਹੀਂ ਨਹੀਂ ਭਾਈ ਸਾਹਿਬ ਦੇਖੋ ਤੁਸੀਂ ਕਦੋਂ ਦਾ ਲੈਂਦੇ ਪਏ ਹੋ ਤੁਸੀਂ ਅੱਜ ਤੱਕ ਤਾਂ ਕੁਛ ਕਦੇ ਮੈਨੂੰ ਕਿਹਾ ਸਾਨੂੰ ਉਲਾਂਭਾ ਨਹੀਂ ਦਿੱਤਾ ਇੱਕ ਹਫ਼ਤੇ ਤੋਂ ਕਹਿ ਰਹੇ ਹੋ ਲੇਕਿਨ ਹਫ਼ਤੇ ਦਾ ਤੁਸੀਂ ਮੈਨੂੰ ਹਫ਼ਤੇ ਦੇ ਵਿੱਚ ਇੱਕ ਵਾਰੀ ਵੀ ਨਹੀਂ ਕਿਹਾ ਅੱਜ ਤੁਸੀਂ ਮੈਨੂੰ ਕਿਹਾ ਏ

ਅੱਛਾ ਅੱਛਾ ਕੋਈ ਕੋਈ ਗੱਲ ਨਹੀਂ ਭਾਈ ਸਾਹਿਬ ਹੁਣ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਆਪਾਂ ਤਾਂ ਤੁਹਾਡੇ ਘਰੇ ਹੁਣ ਆਪਾਂ ਪਿਓਰ ਗਾਂ ਦਾ ਦੁੱਧ ਹੀ ਐਵੇਂ ਕਰਾਂਗੇ ਆਪਾਂ ਕਰਾਂਗੇ ਤੁਹਾਡਾ ਕੱਲ੍ਹ ਤੋਂ ਨਾ ਬਰਤਨ ਹੀ ਵੱਖਰਾ ਲਗਾ ਦਿੰਦੇ ਹਾਂ ਠੀਕ ਹੈ ਭਾਈ ਸਾਹਿਬ ਹਾਂ ਹਾਂ ਹਾਂ ਹਾਂ ਨਹੀਂ ਨਹੀਂ ਨਹੀਂ ਭਾਈ ਸਾਹਿਬ ਬਸ ਕੋਈ ਨਹੀਂ ਤੁਸੀਂ ਸਾਨੂੰ ਕਹਿ ਤਾ ਆਪਾਂ ਤੁਹਾਡਾ ਹੁਣ ਪੂਰਾ ਧਿਆਨ ਰੱਖਾਂਗੇ ਅਤੇ ਭਾਈ ਸਾਹਿਬ ਕੋਈ ਹੋਰ ਘਰ ਅਗਰ ਪੁੱਛਣ ਤਾਂ ਆਪਣਾ ਜ਼ਰੂਰ ਦੱਸਣਾ ਦੁੱਧ ਬਾਰੇ ਅਤੇ ਆਪਾਂ ਲਗਾਉਣਾ ਹੈ ਅਤੇ ਆਪਣਾ ਜਿਹੜਾ ਮੱਖਣ ਵਗੈਰਾ ਵੀ ਸਈ ਨਿਕਲਿਆ ਸੀ ਕਿ ਨਹੀਂ ਮਤਲਬ ਆਹ ਹਫ਼ਤੇ ਦੇ ਵਿੱਚ ਉਲਾਂਭਾ ਠੀਕ ਹੈ ਭਾਈ ਸਾਹਿਬ ਜੀ ਠੀਕ ਹੈ ਠੀਕ